ਮੇਰੇ ਕੋਲ ਇੱਕ ਸੈਮਸੰਗ ਦੇ ਈਅਰਬਡਸ ਜਾਣੀ ਕਿ ਹੈੱਡਫ਼ੋਨ ਪਏ ਸਨ ਹੈੱਡਫ਼ੋਨ ਮੈਂ ਚੰਡੀਗੜ੍ਹ ਸੈਕਟਰ ਬਾਈ ਤੋਂ ਲਿਆਂਦੇ ਸੀ ਅਤੇ ਇਹ ਜੋ ਹੈੱਡਫ਼ੋਨ ਸੀ ਤਕਰੀਬਨ ਪੈਂਤੀ ਸੌ ਚਾਰ ਹਜ਼ਾਰ ਦੇ ਕਰੀਬ ਆਏ ਸਨ ਅਤੇ ਇਹਨਾਂ ਹੈੱਡਫ਼ੋਨਾਂ ਦੀ ਕੁਆਲਟੀ ਇੰਨੀ ਕੁ ਜ਼ਿਆਦਾ ਵਧੀਆ ਵੀ ਨਹੀਂ ਨਿਕਲੀ ਅਤੇ ਇਸ ਜਦੋਂ ਮੈਂ ਇਹ ਹੈੱਡਫ਼ੋਨ ਵਰਤ ਕੇ ਦੇਖੇ ਤਾਂ ਇਹਨਾਂ 'ਚੋ ਕਿਸੇ ਦੀ ਬੇਸ ਵੀ ਠੀਕ ਨ ਅ ਜ਼ਿਆਦਾ ਬੇਸ ਵੀ ਨਹੀਂ ਸੀ ਅਤੇ ਹੈੱਡਫ਼ੋਨਾਂ ਵਿੱਚੋਂ ਅਵਾਜ਼ ਤਿੱਖੀ ਬਹੁਤ ਆਉਂਦੀ ਸੀ ਸਿਰ ਦੁੱਖਣ ਲਾ ਦਿੰਦੇ ਸੀ ਅਤੇ ਜੋ ਹੈੱਡਫ਼ੋਨ ਸੀ ਇਸ ਦਾ ਬੈਟਰੀ ਬੈਕਅੱਪ ਵੀ ਨਹੀਂ ਸੀ ਅੱਧੇ ਘੰਟੇ ਵਿੱਚ ਅ ਈਅਰਫ਼ੋਨ ਡੈਡ ਹੋ ਜਾਂਦੇ ਹਨ ਅਤੇ ਜੋ ਇਸਦਾ ਗਲਾਸ ਹੈ ਕਵਰ ਹੈ ਉਸ 'ਤੇ ਵੀ ਸਕ੍ਰੈਚ ਆ ਗਏ ਸਨ ਜੇਬ 'ਚ ਪਏ ਪਏ ਸਕ੍ਰੈਚ ਆ ਜਾਂਦੇ ਸਨ ਅਤੇ ਇਹਨਾਂ ਹੈੱਡਫ਼ੋਨਾਂ ਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਨਿਕਲੀ ਅਤੇ ਜੇਹੇ ਇਹ ਈਅਰਬਡ ਇੱਕ ਦਿਨ ਚਾਰਜ ਪੁਆਇੰਟ 'ਤੇ ਲਗਾਏ ਹੋਏ ਸਨ ਅਤੇ ਜਦੋਂ ਮੈਂ ਮੁੜ ਕੇ ਆ ਕੇ ਦੇਖਿਆ ਤਾਂ ਇਹ ਸੜ ਚੁੱਕੇ ਹਨ ਇਹਨਾਂ ਨੂੰ ਅੱਗ ਪੈ ਚੁੱਕੀ ਸੀ ਇਹਨਾਂ ਦਾ ਪ੍ਰੋਸੈਸਰ ਠੀਕ ਸ਼ਾਇਦ ਪਰ ਨਾ ਹੋਵੇ ਤਾਂ ਮੈਨੂੰ ਲੱਗਦਾ ਹੈ ਇਹਨੂੰ ਅੱਗ ਪੈ ਗਈ ਅਤੇ ਵੈਸੇ ਵੀ ਇਹਨਾਂ ਦੀ ਠੀਕ ਨਹੀਂ ਸੀ ਕੁਆਲਟੀ ਜ਼ਿਆਦਾ ਈਅਰਬਡਸ ਦੀ ਤਾਂ ਸੈਮਸੰਗ ਵਾਲੇ ਜਿਹੜੇ ਆ ਈਅਰਬਡ ਇਹ ਜ਼ਿਆਦਾ ਵਧੀਆ ਨਹੀਂ ਨਿਕਲੇ